ਹਾਂਜੀ ਆਪਾਂ ਸਾਰੇ ਜਣੇ ਮਤਲਬ ਕਿ ਖ਼ਬਰਾਂ ਸੁਣਨਾ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਮੇਰੀ ਭਾਸ਼ਾ ਹੈਗੀ ਆ ਪੰਜਾਬੀ ਅਤੇ ਮੈਂ ਪੰਜਾਬੀ ਦੇਖਣਾ ਅਤੇ ਪੰਜਾਬੀ ਸੁਣਨਾ ਬੜਾ ਜ਼ਿਆਦਾ ਪਸੰਦ ਕਰਦੀ ਹਾਂ ਠੀਕ ਆ ਅਤੇ ਸਾਡੇ ਮਤਲਬ ਖੇਤਰ ਵਿੱਚ ਪੰਜਾਬੀ ਨੂੰ ਬੜਾ ਜ਼ਿਆਦਾ ਪ੍ਰੈਫਰ ਵੀ ਕੀਤਾ ਜਾਂਦਾ ਅਤੇ ਪੰਜਾਬੀ ਦੀਆਂ ਖ਼ਬਰਾਂ ਬਹੁਤ ਸਾਰੇ ਮਤਲਬ ਟੀ ਵੀਸ ਟੀ ਵੀ 'ਤੇ ਸੁਣਾਈਆ ਜਾਂਦੀਆਂ ਜਿਵੇਂ ਕਿ ਪੀ ਟੀ ਸੀ ਨਿਊਜ਼ ਹੋ ਗਿਆ ਪੀ ਟੀ ਸੀ ਪੰਜਾਬੀ ਹੋ ਗਿਆ ਟੀ ਵੀ ਨਿਊਜ਼ ਹੋ ਗਿਆ ਐਂਡ ਸਿਮਰਨ ਟੀ ਵੀ ਹੋ ਗਿਆ ਮਤਲਬ ਕਿ ਇਹਦੇ ਵਿੱਚ ਆਪਾਂ ਨੂੰ ਆਪਣੇ ਦੇਸ਼ ਦੇ ਬਾਰੇ ਦੱਸਿਆ ਜਾਂਦਾ ਜਾਂ ਆਪਣੇ ਮਤਲਬ ਕਿ ਆਪਣੇ ਲਾਗੇ ਦੁਆਲੇ ਆਲੇ ਦੁਆਲੇ ਕੀ ਹੋਣ ਦਿਆ ਉਹਦੇ ਵਿੱਚ ਦੱਸਿਆ ਜਾਂਦਾ ਹੈ ਅਤੇ ਆਪਣੇ ਮਤਲਬ ਖ਼ਬਰਾਂ ਖ਼ਬਰਾਂ ਵਿੱਚ ਆਪਾਂ ਨੂੰ ਇਹ ਪਤਾ ਲੱਗਦਾ ਵਾ ਕਿ ਹਾਂ ਯਾਰ ਕਿ ਕੱਲ੍ਹ ਜਿਵੇਂ ਰੀਸੈਂਟਲੀ ਇੱਕ ਨਿਊਜ਼ ਆਈ ਆ ਕਿ ਮਤਲਬ ਕਿਫਿਰੋਜ਼ਪੁਰ ਦੇ ਵਿੱਚ ਬੱਸ ਦਾ ਮਤਲਬ ਐਕਸੀਡੈਂਟ ਹੋ ਗਿਆ ਸੀ ਆਪਾਂ ਨੂੰ ਮਤਲਬ ਕਿ ਖ਼ਬਰਾਂ ਤੋਂ ਉਤੇਜਿਤ ਹੁੰਦੇ ਆ ਆਪਾਂ ਪਤਾ ਲੱਗਦਾ ਕਿ ਹਾਂ ਆਪਣੇ ਲਾਗੇ ਬੰਨੇ ਕੀ ਹੋਣ ਦਿਆ ਹੈ ਘਰਾਂ ਵਿੱਚ ਚੋਰੀਆਂ ਹੋਣ ਦੀਆਂ ਹੈ ਰ ਰੋਬਰੀਜ ਹੋਣ ਦੀਆਂ ਇਹਦੇ ਕੇਸ ਹੋਣ ਦੇ ਆ ਨਿਊਜ਼ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਆਪਣੀ ਪੋਲੀਟਿਕਸ ਆ ਉਹ ਆਪਸ 'ਚ ਹੀ ਲੜੀ ਜਾਣ ਦੀ ਆ ਉਹ ਇੱਕ ਦੂਜੇ ਨੂੰ ਨੀਚਾ ਦਿਖਾਈ ਜਾਣ ਦੀ ਆ ਠੀਕ ਆ ਅਤੇ ਖ਼ਬਰਾਂ ਨਿਊਜ਼ ਪੇਪਰ ਵੀ ਇੱਕ ਬੜਾ ਵਧੀਆ ਜ਼ਰੀਆ ਹੈਗਾ ਹੈ ਖ਼ਬਰਾਂ ਪਹੁੰਚਾਉਣ ਦਿਆ ਹੈਗਾ ਪਰ ਜਿਹੜਾ ਆਪਣਾ ਮਤਲਬ ਕਿ ਉਹ ਹੈਗਾ ਨਿਊਜ਼ ਲਾਈਕ ਖ਼ਬਰਾਂ ਟੀ ਵੀ ਸੀ ਟੀ ਵੀ ਪੀ ਟੀ ਸੀ ਨਿਊਜ਼ ਔਰ ਇਹ 'ਤੇ ਹਰ ਟਾਈਮ ਹੀ ਆਪਣੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਹਾਂ ਇੱਥੇ ਆਪਾਂ ਨੂੰ ਇਹ ਮਿਲ ਰਿਹਾ ਉੱਥੇ ਆਪਾਂ ਨੂੰ ਉਹ ਮਿਲ ਰਿਹਾ ਹੈ ਸੋ ਆਪਾਂ ਨੂੰ ਮਤਲਬ ਉਤੇਜਿਤ ਰਹਿਣਾ ਚਾਹੀਦਾ